ਮੱਛੀਆਂ ਫੜਨ ਜਾਂ ਇਸ ਸਬੰਧਿਤ ਕੁੱਝ ਵਾਤਾਵਰਨ ਨੂੰ ਸੰਭਾਲ ਹਨ ਕਿ ਮੱਛਲੀ ਆਬਾਦੀ ਨੂੰ ਜਲ ਪ੍ਰਦੂਸ਼ਣ ਤੋਂ ਬਚਾਓ ਜਦੋਂ ਤੁਸੀਂ ਆਪਣੀ ਬੋਟ ਨੂੰ ਪਾਣੀ ਵਿੱਚ ਲੈ ਜਾਂਦੇ ਹੋ ਤਾਂ ਉਸਨੂੰ ਦੇਹ ਵਿੱਚ ਜਾਂ ਕਹਿ ਲਓ ਸੀਨ ਦੇ ਰੀਸਾਵ ਤੋਂ ਬਚਾਉਣ ਦੇ ਲਈ ਉਸਦਾ ਰੱਖ ਰਖਾਅ ਕਰਦੇ ਹੋ ਜਦੋਂ ਝੀਲਾਂ ਨਹਿਰਾਂ ਨਦੀਆਂ ਸਮੁੰਦਰਾਂ ਅਤੇ ਹੋਰ ਜਲ ਭਰਾਵ ਜਗਾ ਵਿੱਚ ਜ਼ਹਿਰੀਲੇ ਪਦਾਰਥ ਪ੍ਰਵੇਸ਼ ਕਰਦੇ ਹਨ ਤਾਂ ਉਹ ਇਹਨਾਂ ਵਿੱਚ ਘੁਲ ਜਾਂਦੇ ਹਨ ਪਾਣੀ ਵਿੱਚ ਪਏ ਰਹਿੰਦੇ ਹਨ ਜਾਂ ਨੀਚੇ ਇਕੱਠੇ ਹੋ ਜਾਂਦੇ ਹਨ ਜਿਸ ਕਰਕੇ ਪਾਣੀ ਪ੍ਰਦੂਸ਼ਿਤ ਹੁੰਦਾ ਅਤੇ ਉੱਥੇ ਜਲ ਦੀ ਗੁਣਵੱਤਾ ਵਿੱਚ ਕਮੀ ਆ ਜਾਂਦੀ ਹੈ ਅਤੇ ਜਲ ਦੀ ਪ੍ਰਸਥਿਤੀ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਅਤੇ ਅੱਜ ਕੱਲ੍ਹ ਦੇਖਿਆ ਜਾਂਦਾ ਹੈ ਕਿ ਸਮੁੰਦਰਾਂ ਦੇ ਵਿੱਚ ਆਲੇ ਦੁਆਲੇ ਲੋਕ ਪਲਾਸਟਿਕ ਲਿਫਾਫੇ ਆਦਿ ਸਿੱਟਦੇ ਰਹਿੰਦੇ ਹਨ ਜਿਹਦੇ ਨਾਲ ਪਾਣੀ ਬਹੁਤ ਜ਼ਿਆਦਾ ਗੰਦਾ ਹੁੰਦਾ ਜਾ ਰਿਹਾ ਅਤੇ ਬੋਟਿੰਗ ਕਰਦੇ ਹਨ ਲੋਕ ਉਹਦੇ ਵਿੱਚ ਡੀਜ਼ਲ ਇੰਜਨ ਵਾਲੀਆਂ ਕਿਸ਼ਤੀਆਂ ਵਰਤਦੇ ਹਨ ਉਹਦੇ ਨਾਲ ਗੰਦਾ ਪਾਣੀ ਵਿੱਚ ਜਾਂਦਾ ਰਹਿੰਦਾ ਹੈ ਅਤੇ ਇੰਜਨ ਦੇ ਵਿੱਚੋਂ ਨਿਕਲਦਾ ਕਾਲਾ ਪਾਣੀ ਉਹ ਵੀ ਵਿੱਚ ਜਾਂਦਾ ਹੈ ਅਤੇ ਇਸ ਕਰਕੇ ਪਾਣੀ ਨੂੰ ਬਚਾਓ ਅਤੇ ਮੱਛੀਆਂ ਫੜਨ ਵਾਲਿਆਂ ਨੂੰ ਵੀ ਇਹ ਸੁਝਾਅ ਹੁੰਦਾ ਕਿ ਜਿਹੜੀਆਂ ਬੋਟਾਂ ਹਨ ਉਹ ਜ਼ਿਆਦਾ ਤੋਂ ਜ਼ਿਆਦਾ ਸਿੰਪਲ ਯੂ਼ਜ ਕੀਤੀਆਂ ਜਾਣ ਨਹੀਂ ਇੰਜਣ ਵਾਲੀਆਂ ਬੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਗੰਦਾ ਓਇਲ ਛੱਡਦੀਆਂ ਹਨ ਅਤੇ ਪ੍ਰਦੂਸ਼ਣ ਕਰਦੀਆਂ ਹਨ ਅਤੇ ਲੋਕ ਜੋ ਪਲਾਸਟਿਕ ਪਾਣੀ ਦੇ ਵਿੱਚ ਸੁੱਟਦੇ ਹਨ ਉਹਨਾਂ ਨੂੰ ਨਹੀਂ ਸੁੱਟਣਾ ਚਾਹੀਦਾ ਅਤੇ ਉਹ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੁੰਦਾ ਹੈ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ